ਤਕਨੀਕ ਨੇ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਨੂੰ ਬਹੁਤ ਪ੍ਰਭਾਵਿਤ ਕੀਤਾ ਠੀਕ ਹੈ ਉਦੋਂ ਜਦੋਂ ਕਰੋਨਾ ਦੇ ਟਾਈਮ ਦੇ ਵਿੱਚ ਤੁਸੀਂ ਵੇਖੋ ਸਾਲ ਸਾਲ ਬੱਚੇ ਘਰ ਰਹੇ ਉਹਨਾਂ ਨੂੰ ਕਰਕੇ ਬੱਚੇ ਘਰੇ ਪੜ੍ਹੀ ਗਏ ਨਹੀਂ ਤਾਂ ਬਹੁਤ ਮਤਲਬ ਔਖਾ ਕੰਮ ਸੀ ਟੈਕਨੋਲੋਜੀ ਦਾ ਮਤਲਬ ਜ਼ਮਾਨਾ ਬਹੁਤ ਵਧੀਆ ਹੈਗਾ ਇਹਦੇ ਵਿੱਚ ਤਾਂ ਕਿ ਆਪਾਂ ਸਾਰੀ ਜਾਣਕਾਰੀ ਆਪਾਂ ਭਰਾਉ ਤੋਂ ਵੀ ਪ੍ਰਣਾਲੀ ਨੇ ਕਿ ਆਪਾਂ ਬਹੁਤ ਕੀਤਾ ਹੈਗਾ ਤਾਂ ਟੈਕਨੋਲੋਜੀ ਬਹੁਤ ਵਧੀਆ ਹੈਗੀ ਜਿਹੜਾ ਸਿਸਟਮ ਚੱਲ ਰਿਹਾ ਬਹੁਤ ਹੀ ਵਧੀਆ ਹੈਗਾ ਔਰ ਇੱਦਾਂ ਸਿਸਟਮ ਪਹਿਲਾਂ ਨਹੀਂ ਸੀ ਚਲੋ ਹੁਣੇ ਚਾਲੂ ਕੀਤਾ ਬਹੁਤ ਵਧੀਆ ਹੈਗਾ ਬੱਚਾ ਦੇਖ ਕੇ ਸਗੋਂ ਬਹੁਤ ਇਹ ਤੋਂ ਪ੍ਰਭਾਵਿਤ ਵੀ ਹੁੰਦੇ ਆ ਬੱਚਿਆਂ ਨੂੰ ਹੁਣ ਜਾਣਕਾਰੀ ਮਿਲ ਰਹੀ ਹੈ ਬੈਠੇ ਆ ਤਾਂ ਸਾਰਾ ਕੁਝ ਦੇਖ ਰਹੇ ਨੈੱਟ ਦਾ ਜ਼ਮਾਨਾ ਹੈਗਾ ਜੋ ਵੀ ਆਪਾਂ ਚੀਜ਼ ਆਪਾਂ ਨਹੀਂ ਜਾਣਕਾਰੀ ਉਹ ਆਪਾਂ ਜਦੋਂ ਨੈਟ ਨੂੰ ਆਪਾਂ ਓਨ ਕਰਕੇ ਆਪਾਂ ਸਿਸਟਮ ਨੂੰ ਦੇਖ ਸਕਦੇ ਹਾਂ ਉਦੋਂ ਵਧੀਆ ਢੰਗ ਨਾਲ ਆਪਾਂ ਨੂੰ ਆਪਦਾ ਜੀਵਨ ਆਪਦਾ ਪ੍ਰਫੁੱਲਤ ਜੀਵਨ ਪ੍ਰਫੁੱਲਤ ਕਰ ਸਕਦੇ ਹਾਂ